ਮੈਂ ਬਚਪਨ ਤੋਂ ਹੀ ਫੋਨ ਵਿੱਚ ਰੁਚੀ ਰੱਖਦਾ ਸੀ ਬਚਪਨ ਵਿੱਚ ਮੈਂ ਟੀਵੀ ਉੱਪਰ ਸ ਕਾਫੀ ਸਿੰਗਰਾਂ ਨੂੰ ਗਾਉਂਦੇ ਹੋਏ ਸੁਣਿਆ ਸੀ ਜਿਸ ਕਾਰਨ ਹੌਲੀ ਹੌਲੀ ਗਾਉਣ ਗਾਉਣ ਵਿੱਚ ਮੇਰੀ ਮੇਰਾ ਇੰਟਰਸਟ ਕਾਫੀ ਵਧਿਆ ਅਤੇ ਜਦ ਮੈਂ ਸਕੂਲ ਵਿੱਚ ਪੜ੍ਹਿਆ ਤਾਂ ਸਭ ਤੋਂ ਪਹਿਲਾਂ ਮੈਨੂੰ ਦਸ ਸਾਲ ਦੀ ਉਮਰ ਵਿੱਚ ਗਾਣਾ ਸ਼ੁਰੂ ਕਰ ਦਿੱਤਾ ਕਿਉਂਕਿ ਸਕੂਲ ਵਿੱਚ ਕਾਫੀ ਕੰਪੀਟੀਸ਼ਨ ਵਗੈਰਾ ਹੁੰਦੇ ਸਨ ਜਿਹਨਾਂ ਵਿੱਚ ਸਿੰਗਿੰਗ ਕੰਪੀਟੀਸ਼ਨ ਵਿੱਚ ਮੈਂ ਸਭ ਤੋਂ ਪਹਿਲਾਂ ਗਾਣਾ ਗਾਇਆ ਕਿਉਂਕਿ ਕਿਉਂਕਿ ਮੈਂ ਬਚਪਨ ਤੋਂ ਇਸ ਗਾਣੇ ਸੁਣਦਾ ਆ ਰਿਹਾ ਸੀ ਇਸ ਕਾਰਨ ਮੇਰਾ ਇੰਟਰਸਟ ਇਸ ਵਿੱਚ ਕਾਫੀ ਸੀ ਅਤੇ ਮੈਂ ਇਸ ਵਿੱਚ ਪਹਿਲੀ ਵਾਰ ਸ ਆਪਣੇ ਪੰਜਾਬ ਸਕੂਲ ਵਿੱਚ ਡਿਸਟ੍ਰਿਕ ਲੈਵਲ ਦੇ ਚ ਗਾਣੇ ਵਿੱਚ ਪਹਿਲੀ ਵਾਰ ਪਹਿਲੇ ਨੰਬਰ 'ਤੇ ਆਇਆ ਸੀ ਜਿਸ ਕਾਰਨ ਹੌਲੀ ਹੌਲੀ ਮੇਰੀ ਰੁਚੀ ਇਸ ਵਿੱਚ ਵੱਧਦੀ ਗਈ ਅਤੇ ਮੈਂ ਕਾਫੀ ਤਰੀਕੇ ਨਾਲ ਇ ਇਸ ਨੂੰ ਗਾਉਣ ਨੂੰ ਜਾਰੀ ਰੱਖਿਆ